ਸਮਕਾਲੀ ਲੇਖਕ ਮੇਰੀ ਨਿਗ੍ਹਾ 'ਚ ਤਾਂ ਕਈ ਨੇ ਪਰ ਜਿਹਨਾਂ ਨੂੰ ਮੈਂ ਜ਼ਿਆਦਾ ਪੜ੍ਹਿਆ ਪਸੰਦ ਕੀਤਾ ਉਹਨਾਂ ਵਿੱਚੋਂ ਮੈਂ ਜ਼ਿਆਦਾ ਖੁਸ਼ਵੰਤ ਸਿੰਘ ਜੀ ਸੀਗੇ ਜਿਹਨਾਂ ਦੀ ਜਿਹੜੀ ਲਿਖਣੀ ਬਹੁਤ ਵਧੀਆ ਸੀ ਬਹੁਤ ਲਿਖਦੇ ਸੀ ਉਹਨਾਂ ਦੀ ਪਾਕਿਸਤਾਨ ਤੋਂ ਜਦੋਂ ਦੰਗੇ ਜਦੋਂ ਦੇਸ਼ ਅਜਾ ਬਣਿਆ ਦੂਜਾ ਪਾਕਿਸਤਾਨ ਅਤੇ ਭਾਰਤ ਜਦੋਂ ਬਣਿਆ ਨਾ ਪਾਕਿਸਤਾਨ ਅਲੱਗ ਹੋ ਗਿਆ ਸੀ ਉਦੋਂ ਦਾ ਜੋ ਹਾਲਾਤ ਉਹਨਾਂ ਨੇ ਲਿਖੇ ਆ ਜੋ ਪਾਕਿਸਤਾਨ ਦੇ ਵਿੱਚ ਪੰਜਾਬੀ ਰਹਿੰਦੇ ਸੀ ਜੋ ਉਹਨਾਂ ਦੇ ਹਾਲਾਤ ਓਨੇ ਉਹਨਾਂ ਦੇ ਨਾਵਲ ਟਰੇਨ ਟੂ ਪਾਕਿਸਤਾਨ ਇੱਕ ਕਿਤਾਬ ਸੀ ਲਿਖੀ ਪੜ੍ਹੀ ਉਹ ਬਹੁਤ ਅੱਛੀ ਸੀ ਉਹਦੇ ਵਿੱਚ ਉਹਨਾਂ ਨੇ ਲਿਖਿਆ ਜੋ ਦੁੱਖ ਸੀ ਲੋਕਾਂ ਦੇ ਦੁੱਖ ਤਕਲੀਫਾਂ ਆਈਆਂ ਸੰਤਾਲੀ 'ਚ ਆਪਣੇ ਘਰ ਛੱਡ ਕੇ ਆਏ ਉੱਧਰੋਂ ਪਾਕਿਸਤਾਨ ਤੋਂ ਅਤੇ ਉੱਥੇ ਅਤੇ ਜੋ ਉਹਨਾਂ ਦਾ ਪਾਕਿਸਤਾਨ 'ਚ ਪਿਆਰ ਸੀ ਮੁਸਲਮਾਨਾਂ ਨਾਲ ਹਿੰਦੂਆਂ ਨਾਲ ਸਿੱਖਾਂ ਦਾ ਜੋ ਆਪਸੀ ਪਿਆਰ ਉਹਦੇ 'ਚ ਦਰਸਾਇਆ ਗਿਆ ਅਤੇ ਜੋ ਉੱਥੇ ਦੇ ਵਿਛੋੜੇ ਦਾ ਦਰਦ ਸੀ ਉਹ ਦਰਸਾਇਆ ਗਿਆ ਉਹਨਾਂ ਦੀ ਕਿਤਾਬ ਟਰੇਨ ਟੂ ਪਾਕਿਸਤਾਨ ਜਿਹੜੀ ਸੀ ਉਹ ਬਹੁਤ ਅੱਛੀ ਸੀ ਮੈਂ ਉਹਨਾਂ ਨੂੰ ਇਸ ਕਰਕੇ ਅੱਛਾ ਸਮਝਦਾ ਉਹ ਜੋ ਸੱਚ ਇੱਕ ਦਿਖਾਉਣ ਦਾ ਤਰੀਕਾ ਔਰ ਬਿਲਕੁਲ ਘਰੇਲੂ ਤਰੀਕੇ ਨਾਲ ਦਿਖਾ ਦਿਖਾਇਆ ਉਹਨਾਂ ਨੇ ਆਪਣੀ ਲਿਖਣੀ ਦੇ ਵਿੱਚ ਇਸ ਕਰਕੇ ਖੁਸ਼ਵੰਤ ਸਿੰਘ ਦੀਆਂ ਮੈਂ ਹੋਰ ਵੀ ਲਿਖਤਾਂ ਪੜ੍ਹੀਆਂ ਬਹੁਤ ਹੀ ਸੱਚਾਈ ਲਿਖਦੇ ਸੀ ਇਸ ਕਰਕੇ ਮੈਂ ਉਹਨਾਂ ਦੀ ਜਿਹੜੀ ਲਿਖਤ ਤੋਂ ਬਹੁਤ ਜਿਆਦਾ ਪ੍ਰਭਾਵਿਤ ਆ ਖੁਸ਼ਵੰਤ ਸਿੰਘ ਦੀ